ਆਪਣੇ ਵਿਹੜੇ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਦੇ ਕੁਝ ਸੁਝਾਅ ਵਿੱਚ ਪ੍ਰਕਾਰ ਹਨ ਪੰਛੀਆਂ ਦਾ ਦਾਣਾ ਵੱਖ ਵੱਖ ਕਿਸਮ ਦੇ ਦਾਣੇ ਬੀਜ ਅਤੇ ਫਲ ਰੱਖੋ ਜਿਵੇਂ ਕਿ ਸੂਰਜਮੁਖੀ ਦੇ ਬੀਜ ਮੱਕੀ ਅਤੇ ਛੋਲੇ ਫਲ ਜਿਵੇਂ ਕਿ ਬੇਰੀ ਆਦਿ ਪਾਣੀ ਦਾ ਸਰੋਤ ਇੱਕ ਛੋਟਾ ਪਾਣੀ ਦਾ ਕੋਲਾ ਜਾਂ ਫਰਵਾਰਾ ਬਣਾਓ ਪੰਛੀ ਪਾਣੀ ਪੀਣ ਅਤੇ ਨਹਾਉਣ ਨੂੰ ਲਈ ਆਉਣਗੇ ਜੇ ਚਿੜੀ ਦੇ ਘੋਂਸਲੇ ਪੰਛੀਆਂ ਲਈ ਘੋਂਸਲੇ ਬਣਾਉਣ ਦੇ ਕੂੜੇ ਜਾਂ ਪੰਛੀਆਂ ਦੇ ਘਰ ਲਗਾਓ ਇਹ ਉਹਨਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਏਗਾ ਬਾਗਬਾਨੀ ਫੁੱਲਾਂ ਅਤੇ ਫਲਦਾਰ ਬੂਟੇ ਲਗਾਓ ਜੋ ਪੰਛੀਆਂ ਨੂੰ ਭਾਉਂਦੇ ਹਨ ਖਾਸਕਰ ਮੂਲੀਆਂ ਅਤੇ ਬੇਰੀਆਂ ਵਾਲੇ ਬੂਟੇ ਰਸਾਇਣ ਮੁ ਮੁਕਤ ਵਾਤਾਵਰਨ ਰਸਾਇਣਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਘਟਾਓ ਕਿਉਂਕਿ ਇਹ ਪੰਛੀਆਂ ਲਈ ਨੁਕਸਾਨਦਾਇਕ ਹੋ ਸ ਸਕਦੀਆਂ ਹਨ ਫਲ ਦੇ ਟੁਕੜੇ ਬਾਹਰ ਖੁੱਲ੍ਹੇ ਵਿੱਚ ਫਲ ਦੇ ਟੁਕੜੇ ਰੱਖੋ ਜਿਵੇਂ ਕਿ ਸੇਬ ਕੇਲਾ ਅਤੇ ਸੰਤਰਾ ਕੁਦਰਤੀ ਅਸਥਾਨ ਵ ਵਿਹੜੇ ਵਿੱਚ ਕੁਝ ਹਰੇਕ ਦੇ ਰੁੱਖ ਬੂਟੇ ਛੱਡੋ ਜਿੱਥੇ ਪੰਛੀ ਆਰਾਮ ਕਰ ਸਕਣ ਇਹਨਾਂ ਸਜ਼ਾਵਾਂ ਨੂੰ ਅਪਣਾਉਣ ਨਾਲ ਸਾਡੇ ਵਿਹੜੇ ਵਿੱਚ ਵੱਖ ਵੱਖ ਕਿਸਮ ਦੇ ਪੰਛੀ ਆ ਸਕਦੇ ਹਨ ਇਹ ਸਾਡੇ ਬਾਗ ਨੂੰ ਵੀ ਸੋਹਣਾ ਬਣਾਉਣਗੇ